ਜੀ ਨਹੀਂ ਵੈਸੇ ਤਾਂ ਕੋਈ ਖਾਸ ਕਹਾਣੀ ਨਹੀਂ ਹੈ ਕਿਉਂਕਿ ਪੰਜਾਬ ਦੇ ਵਿੱਚ ਲੋਕ ਨਾਚ ਪਹਿਲੇ ਤੋਂ ਹੀ ਪਾ ਪਾਇਆ ਜਾ ਰਿਹਾ ਹੈ ਜੇ ਅਸੀਂ ਗੱਲ ਕਰੀਏ ਭੰਗੜੇ ਦੀ ਭੰਗੜਾ ਵੀ ਕਾਫੀ ਸਾਰੇ ਲੋਕ ਕਰਦੇ ਨੇ ਆਪਣੇ ਵਿਸਾਖੀ ਦੇ ਉੱਤੇ ਜਾਂ ਸਾਡੇ ਪਿੰਡ ਦੇ ਵਿਚ ਅਸੀਂ ਛਿੰਝਾਂ ਦੇ ਉੱਤੇ ਕਾਫੀ ਜ਼ਿਆਦਾ ਭੰਗੜਾ ਕਰਵਾਉਂਦੇ ਨੇ ਕਾਫੀ ਸਾਰੇ ਲੋਕ ਭੰਗੜੇ ਤੋਂ ਜ਼ਿਆਦਾ ਬਹੁਤ ਜ਼ਿਆਦਾ ਪ੍ਰਭਾਵਿਤ ਨੇ ਪੰਜਾਬ ਦੇ ਵਿੱਚ ਕਿਉਂਕਿ ਪੰਜਾਬ ਦਾ ਲੋਕ ਨਾਚ ਭੰਗੜਾ ਹੀ ਹੈ ਅਤੇ ਕਾਫੀ ਸਾਰੇ ਲੋਕ ਇਸ ਤੋਂ ਇਸ ਲਈ ਵੀ ਪ੍ਰਭਾਵਿਤ ਨੇ ਕਿਉਂਕਿ ਕਾਫੀ ਸਾਰੇ ਲੋਕ ਭੰਗੜੇ ਨੂੰ ਆਪਣਾ ਇੱਕ ਲੋਕ ਨਾਚ ਵੀ ਮੰਨਣ ਕਰਕੇ ਕਾਫੀ ਸਾਰੇ ਲੋਕ ਇਹਨੂੰ ਪਸੰਦ ਵੀ ਬਹੁਤ ਜ਼ਿਆਦਾ ਕਰਦੇ ਨੇ ਲੋਕ ਨਾਚ ਹੋਣ ਕਰਕੇ ਭੰਗੜਾ ਹਰ ਕੋਈ ਪਾਉਂਦਾ ਆ ਹਰ ਕੋਈ ਇਸਨੂੰ ਪਾ ਸਕਦਾ ਹੈ ਹਰ ਕੋਈ ਨੂੰ ਕਰ ਸਕਦਾ ਹੈ ਪੰਜਾਬੀ ਭੰਗੜਾ ਅੱਜ ਦੇ ਟਾਈਮ 'ਚ ਕਿਹਾ ਜਾਵੇ ਤਾਂ ਪੂਰੇ ਧਰਤੀ ਦੇ ਉੱਤੇ ਸਾਰੀ ਜਗ੍ਹਾ ਸਾਰਿਆਂ ਨੂੰ ਪਤਾ ਹੈ ਕਿ ਭੰ ਭੰਗੜਾ ਕੀ ਹੁੰਦਾ ਹੈ ਭੰਗੜੇ ਦੀ ਗੱਲ ਕਰੀਏ ਤਾਂ ਹਰ ਕੋਈ ਇਹਨੂੰ ਪਾਉਣ 'ਚ ਝਿਜਕਚਾਉਂਦਾ ਨਹੀਂ ਵੈਸੇ ਤਾਂ ਕੋਈ ਖਾਸ ਕਥਾ ਜਾਂ ਉਹ ਨਹੀਂ ਹੈਗੀ